ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਪ੍ਰਵਾਨ ਕਰਦਾ ਜੋ ਤੁਸੀਂ ਮੇਰੀ ਪ੍ਰਵਾਨ ਕਰੋ ਮੈਂ ਤੁਹਾਡੇ ਹੋਟਲ ਦੇ ਵਿੱਚੋਂ ਇੱਕ ਓਡਰ ਕੀਤਾ ਸੀ ਜਿਸ ਦੇ ਵਿੱਚ ਛੇ ਚਪਾਤੀਆਂ ਸ਼ਾਹੀ ਪਨੀਰ ਮਟਰ ਪਨੀਰ ਰਾਇਤਾ ਅਤੇ ਸਲਾਦ ਰਾਇਤਾ ਅਤੇ ਇੱਕ ਡਰਾਈ ਪਾਪੜ ਜੋ ਕਿ ਮੈਂ ਤੁਹਾਨੂੰ ਓਡਰ ਕੀਤਾ ਸੀ ਅਤੇ ਉਸ ਨੂੰ ਮੈਂ ਰੱਦ ਕਰਨਾ ਚਾਹੁੰਦਾ ਹਾਂ ਕਿਉਂਕਿ ਰੱਦ ਕਰਨ ਦਾ ਮੇਰਾ ਕਾਰਨ ਹੈ ਮੈਂ ਕੈਸ਼ ਓਨ ਡਿਲੀਵਰੀ ਦੇ ਦੇ ਸਕਦਾ ਤੁਹਾਨੂੰ ਜੋ ਕਿ ਡਿਲੀਵਰੀ ਦੇ ਮ ਡਿਲੀਵਰੀ ਕਰਨ ਸਮੇਂ 'ਤੇ ਮੈਂ ਨਕਦ ਤੁਹਾਨੂੰ ਦੇਵਾਂਗਾ ਕਿਰਪਾ ਕਰਕੇ ਮੈਨੂੰ ਇਹ ਫੈਸਲਿਟੀ ਦਿੱਤੀ ਜਾਵੇ ਮੈਂ ਕੈਂਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਤੁਹਾਡੀ ਐਪ ਦਾ ਕੋਡ ਮੈਨੂੰ ਦ੍ਰਿਸ਼ ਨਹੀਂ ਹੋ ਰਿਹਾ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਮੈਂ ਆਪਣੀ ਆਪਣੇ ਮਨ ਪਸੰਦ ਜੋ ਭੋਜਨ ਮੈਂ ਓਡਰ ਕੀਤਾ ਹੈ ਉਸ ਦਾ ਮੈਂ ਡਿਲੀਵਰੀ ਸਮੇਂ ਪ੍ਰ ਨਗਦ ਪ੍ਰਦਾਨ ਕਰਾਂਗਾ ਕਿਰਪਾ ਕਰਕੇ ਮੇਰੀ ਸੁਣਵਾਈ ਸੁਣੀ ਜਾਵੇ